ਹੈਲੋ ਸਤਿ ਸ਼੍ਰੀ ਅਕਾਲ ਸਿੱਧੂ ਟਰੈਵਲ ਏਜੰਸੀ ਮੈਂ ਪਰਵਿੰਦਰ ਗੱਲ ਕਰ ਰਹੀ ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਾਰ ਚਾਹੀਦੀ ਹੈ ਘੁੰਮਣ ਦੇ ਲਈ ਅਸੀਂ ਦਸ ਮੈਂਬਰ ਹੋਵਾਂਗੇ ਅਤੇ ਇਹਦੇ ਲਈ ਸਾਨੂੰ ਕੁਛ ਬੇਸਿਕ ਸਹੂਲਤਾਂ ਵਾਲੀ ਕਾਰ ਚਾਹੀਦੀ ਹੈ ਇਹਦੇ ਵਿੱਚ ਸਕਰੀਨ ਹੋਵੇ ਬੱਚੇ ਵੀ ਨਾਲ਼ ਜਾ ਰਹੇ ਨੇ ਤਾਂ ਥੋੜ੍ਹਾ ਲੰਬੇ ਸਫ਼ਰ ਦੇ ਵਿੱਚ ਸਹੀ ਰਹਿੰਦਾ ਏਸੀ ਅਤੇ ਹੀਟਰ ਹੋਣਾ ਜ਼ਰੂਰੀ ਹੈ ਕਿਉਂਕਿ ਉੱਧਰ ਗਰਮੀ ਕਹਿੰਦੇ ਹੈਗੀ ਆ ਰਾਜਸਥਾਨ 'ਚ ਇਸ ਟਾਈਮ ਅਤੇ ਇਸ ਤੋਂ ਇਲਾਵਾ ਥੋੜ੍ਹੀ ਜਿਹੀ ਜਗ੍ਹਾ ਜ਼ਿਆਦਾ ਵਾਲੀ ਕਾਰ ਚਾਹੀਦੀ ਹੈ ਕਿਉਂਕਿ ਸਾਡਾ ਸਮਾਨ ਥੋੜ੍ਹਾ ਜ਼ਿਆਦਾ ਹੋ ਜਾਵੇਗਾ ਅਸੀਂ ਮੈਂਬਰ ਵੀ ਜ਼ਿਆਦਾ ਅਤੇ ਜੇ ਕਾਰ ਵੱਡੀ ਕਾਰ ਹੋਵੇ ਜਾਂ ਕੋਈ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੋਵੇਗੀ ਵੀਹ ਤਰੀਕ ਨੂੰ ਜਾਂ ਫਿਰ ਟਰੈਵਲ ਟੈਂਪੂ ਜੇ ਹੈਗਾ ਤਾਂ ਉਹ ਕਰ ਦੇਣਾ ਬੁੱਕ ਹਾਂਜੀ ਅਤੇ ਉਹਦੇ ਵਿੱਚ ਸਾਨੂੰ ਜਿਹੜਾ ਵੀ ਤੁਹਾਡਾ ਪੇਮੈਂਟ ਦਾ ਮੋਡ ਹੈ ਉਹ ਦੱਸ ਦਿਓ ਅਤੇ ਬਾਕੀ ਜਿਹੜੀ ਫਰਦਰ ਇਨਫੋਰਮੇਸ਼ਨ ਰਹਿੰਦੀ ਹੋਵੇਗੀ ਉਹ ਤੁਸੀਂ ਮੈਨੂੰ ਵਟਸਐਪ ਕਰ ਦਿਓ ਇਹ ਮੇਰੀ ਬੁਕਿੰਗ ਤੁਸੀਂ ਕਨਫਰਮ ਕਰ ਲਿਓ ਇੱਕ ਵਾਰੀ ਥੈਂਕ ਯੂ